ਮੈਨੂੰ ਰਸੋਈ 'ਚ ਕੰਮ ਕਰਨਾ ਬਹੁਤ ਪਸੰਦ ਹੈ ਮੈਂ ਉੱਥੇ ਘੰਟਿਆਂ ਬਧੀ ਖੜ੍ਹ ਕੇ ਖਾਣਾ ਪਕਾ ਸਕਦੀ ਹਾਂ ਪਰ ਇੱਕ ਰੈਸਪੀ ਮੈਂ ਬਿਨਾਂ ਜਾਣੇ ਹੀ ਬਣਾਈ ਸੀ ਉਹ ਸੀ ਚਾਵਲ ਮੈਂ ਮੇਰੀ ਮੰਮੀ ਨੂੰ ਬਣਾਉਂਦੇ ਦੇਖਿਆ ਸੀ ਰਸੋਈ ਦੇ ਵਿੱਚ ਚਾਵਲ ਤਾਂ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਕੀ ਕੀਤਾ ਪਹਿਲਾਂ ਮੈਂ ਤੜਕਾ ਤਿਆਰ ਕੀਤਾ ਮ ਘਿਓ ਦੇ ਵਿੱਚ ਮੈਂ ਕੁਛ ਪਿਆਜ਼ ਟਮਾਟਰ ਜ਼ੀਰਾ ਐਵੇਂ ਦੇ ਕੁਛ ਮਸਾਲੇ ਪਾਏ ਅਤੇ ਉਸ ਤੋਂ ਬਾਅਦ ਮੈਂ ਜਿਹੜੇ ਚਾਵਲ ਸੀ ਉਹ ਪਾਣੀ ਦੇ ਵਿੱਚ ਸਿੰਪਲ ਉਬਾਲੇ ਅਤੇ ਉਬਾਲਣ ਤੋਂ ਬਾਅਦ ਜਿਹੜਾ ਉਹਨਾਂ ਦਾ ਪਾਣੀ ਸੀਗਾ ਉਹ ਮੈਂ ਕੱਢਿਆ ਉਹਦੇ ਨਾਲ਼ ਕਹਿੰਦੇ ਚੌਲਾਂ ਦੇ ਵਿੱਚ ਜਿਹੜੀ ਬਾਈਵ ਹੁੰਦੀ ਆ ਉਹ ਨਿਕਲ ਜਾਂਦੀ ਆ ਅਤੇ ਉਹ ਆਪਾਂ ਨੂੰ ਤੰਗ ਨਹੀਂ ਕਰਦੀ ਅਤੇ ਫਿਰ ਉਹ ਚੌਲ ਹਲਕੇ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ